ਕਰਜ਼ ਮੁਆਫੀ ਕਿਸਾਨਾਂ ਨੂੰ ਆਰਥਿਕ ਸਹਾਰਾ ਪ੍ਰਦਾਨ ਕਰਵਾਉਣ ਦਾ ਇੱਕ ਤਰੀਕਾ ਹੁੰਦਾ ਹੈ ਇਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਰ ਸਕਦੀ ਹੈ ਇਸ ਨਾਲ ਕਿਸਾਨਾਂ ਦੇ ਆਰਥਿਕ ਦਬਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਤਾਂ ਕਿ ਇਹ ਕਿਸਾਨ ਆਪਣੀਆਂ ਫਸਲਾਂ ਨੂੰ ਸਹੀ ਸਮੇਂ ਅਤੇ ਸੁਖਾਲੇ ਤਰੀਕੇ ਨਾਲ ਉਗਾ ਕੇ ਮੰਡੀਆਂ ਵਿੱਚ ਪਹੁੰਚਾ ਸਕਣ ਜਿਸ ਦੇ ਨਤੀਜੇ ਕਿਸਾਨਾਂ ਨੂੰ ਅਧਿਕ ਸ਼ਕਤੀ ਦਿੱਤੀ ਜਾ ਸਕਦੀ ਹੈ ਕਿਸਾਨਾਂ ਨੂੰ ਕਰਜ਼ ਮੁਆਫੀ ਅਤੇ ਆਧੁਨਿਕ ਤਕਨੀਕਾਂ ਨੂੰ ਅਦੌਲਤ ਕਰਨ ਦੀ ਆਵਸ਼ਕਤਾ ਹੁੰਦੀ ਹੈ ਕਿਸਾਨਾਂ ਨੂੰ ਕਿਸਾਨ ਕਰਜ਼ ਮੁਆਫੀ ਦੀ ਯੋਜਨਾ ਲੈਣ 'ਤੇ ਕਈ ਲਾਭ ਹੁੰਦੇ ਹਨ ਅਤੇ ਜਿਹਨਾਂ ਨੂੰ ਲੈਣ ਲਈ ਉਹਨਾਂ ਨੂੰ ਕਈ ਮਾਪਦੰਡਾਂ ਤੋਂ ਗੁਜਰਨਾ ਪੈਂਦਾ ਹੈ ਜਿਵੇਂ ਕਿ ਕਿਸਾਨਾਂ ਨੂੰ ਇਸ ਸਕੀਮ ਦਾ ਫਾਇਦਾ ਚੁੱਕਣ ਲਈ ਬੈਂਕ ਅਕਾਊਂਟ ਵਾਲਿਆਂ ਨੂੰ ਬੈਂਕ ਵਾਲਿਆਂ ਨੂੰ ਪੱਚੀ ਪ੍ਰਤੀਸ਼ਤ ਲੋਨ ਦਾ ਹਿੱਸਾ ਜਿਸ ਬੈਂਕ ਤੋਂ ਉਹ ਲੋਨ ਲੈ ਰਹੇ ਹਨ ਉਹਨਾਂ ਨੂੰ ਪ੍ਰਦਾਨ ਕਰਨਾ ਪੈਂਦਾ ਹੈ ਇਸ ਨਾਲ ਉਹ ਕਿਸਾਨ ਇਸਦਾ ਲਾਭ ਲੈ ਸਕਦੇ ਹਨ ਅਤੇ ਆਪਣੀਆਂ ਜ਼ਰੂਰਤਾਂ ਨੂੰ ਪੂਰੇ ਕਰਦੇ ਹੋਏ ਆਪਣੇ ਫਸਲਾਂ ਨੂੰ ਉਗਾ ਸਕਦੇ ਹਨ ਅਤੇ ਉਹਨਾਂ ਨੂੰ ਮੰਡੀਆਂ ਵਿੱਚ ਪਹੁੰਚਾਉਣ ਵਿੱਚ ਸਫਲ ਹੋ ਸਕਦੇ ਹਨ ਇਨ ਇਸ ਤਰ੍ਹਾਂ ਕਿਸਾਨ ਆਪਣਾ ਜੀਵਨ ਸੁਖਾਲਾ ਕਰ ਸਕਦੇ ਹਨ ਅਤੇ ਉਹਨਾਂ ਨੂੰ ਕਰਜ਼ ਮੁਆਫੀ ਦੀਆਂ ਸਕੀਮਾਂ ਦੀ ਆਰਥਿਕ ਸਹਾਰ ਸਹਾਇਤਾ ਮਿਲ ਸਕਦੀ ਹੈ